ਹਾਂ ਅਜਿਹੇ ਬਹੁਤ ਦਿਨ ਹੁੰਦੇ ਹਨ ਜਿਹਨਾਂ ਵਿੱਚ ਮੈਂ ਡਰਾਇੰਗ ਨੂੰ ਨਹੀਂ ਕਰ ਪਾਉਂਦੀ ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਬਹੁਤ ਜ਼ਿਆਦਾ ਥੱਕੀ ਹੁੰਦੀ ਹਾਂ ਜਿਵੇਂ ਕਿ ਪੇਪਰਾਂ ਦੇ ਦਿਨ ਅਤੇ ਜਦੋਂ ਕਿ ਕੋਲੇਜ ਦਾ ਕੋਈ ਵੀ ਪ੍ਰੈਕਟੀਕਲ ਕੰਮ ਹੁੰਦਾ ਹੈ ਉਦੋਂ ਮੈਂ ਆਪਣੀ ਡਰਾਇੰਗ ਨੂੰ ਟਾਈਮ ਨਹੀਂ ਦੇ ਪਾਉਂਦੀ ਅਤੇ ਨਾ ਹੀ ਮੇਰੇ 'ਚ ਇੰਨੀ ਸ਼ਕਤੀ ਹੁੰਦੀ ਹੈ ਕਿ ਮੈਂ ਇੰਨਾ ਆਪਣਾ ਧਿਆਨ ਲਗਾ ਕੇ ਡਰਾਇੰਗ ਕਰ ਸਕਾਂ ਇਸ ਲਈ ਮੈਂ ਕਈ ਦਿਨਾਂ ਲਈ ਇਨ ਡਰਾਇੰਗ ਤੋਂ ਬਰੇਕ ਲੈਂਦੀ ਹਾਂ ਮੈਂ ਆਪਣੀ ਡਰਾਇੰਗ ਅਤੇ ਆਪਣੇ ਹੋਰ ਕੰਮਾਂ ਨੂੰ ਬੈਲੈਂਸ ਕਰਨ ਲਈ ਟਾਈਮ ਟੇਬਲ ਵਰਤਦੀ ਹਾਂ ਅਤ ਕਿਉਂਕਿ ਜਦੋਂ ਵੀ ਮੇਰਾ ਮਾਇੰਡ ਫਰੈਸ਼ ਹੁੰਦਾ ਹੈ ਮੈਂ ਉਦੋਂ ਡਰਾਇੰਗ ਕਰਦੀ ਹਾਂ ਅਤੇ ਜਦੋਂ ਵੀ ਮੈਂ ਕਈ ਵਾਰ ਜਦੋਂ ਮੈਂ ਰਾਤ ਨੂੰ ਫ੍ਰੀ ਹੁੰਦੀ ਹਾਂ ਉਦੋਂ ਵੀ ਮੈਂ ਡਰਾਇੰਗ ਕਰਦੀ ਹਾਂ ਕਿਉਂਕਿ ਮੇਰੇ ਡਰਾਇੰਗ ਮੇਰੀ ਹੋਬੀ ਹੈ ਅਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਵੀ ਮੈਂ ਡਰਾਇੰਗ ਕਰਦੀ ਹਾਂ ਮੇਰੇ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ ਇਸ ਲਈ ਮੈਂ ਦਿਨ ਵਿੱਚ ਇੱਕ ਜਾਂ ਦੋ ਘੰਟੇ ਡਰਾਇੰਗ ਕਰਦੀ ਹਾਂ ਜਾਂ ਸੁਬਹਾ ਦੇ ਵੇਲੇ ਜਾਂ ਸ਼ਾਮ ਵੇਲੇ ਧੰਨਵਾਦ